ਖੇਤੀਬਾੜੀ ਉਤਪਾਦਾਂ ਨੂੰ ਸਥਾਨਕ ਬਜ਼ਾਰਾਂ ਤੱਕ ਪਹੁੰਚਾਉਣ ਵਿੱਚ ਇੱਕ ਆਮ ਕਿਸਾਨ ਨੂੰ ਬਹੁਤ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਵੇਂ ਕਿ ਉਹਨੂੰ ਕਿਸਾਨ ਕੋਲ਼ ਆਪਣਾ ਕੋਈ ਸਾਧਨ ਨਹੀਂ ਹੈ ਆਪਣੀ ਫਸਲ ਜਾਂ ਆਪਣੀ ਸਬਜ਼ੀ ਨੂੰ ਆਪਣੀ ਖੇਤੀਬਾੜੀ ਦੇ ਉਤਪਾਦ ਨੂੰ ਬਜ਼ਾਰ ਤੱਕ ਪਹੁੰਚਾਉਣ ਲਈ ਤਾਂ ਉਸ ਨੂੰ ਆਪਣਾ ਉਤਪਾਦ ਬਜ਼ਾਰ ਤੱਕ ਪਹੁੰਚਾਉਣ ਲਈ ਕਿਰਾਏ 'ਤੇ ਸਾਧਨ ਲ ਲਿਜਾ ਕੇ ਛੱਡਣਾ ਪੈਂਦਾ ਹੈ ਅਤੇ ਜਿਸ ਦਾ ਉਸਨੂੰ ਵਾਹਵਾ ਕਰਾਇਆ ਦੇਣਾ ਪੈਂਦਾ ਹੈ ਏ ਇਸ ਇਸ ਤਰ੍ਹਾਂ ਖੇਤੀਬਾੜੀ ਦੇ ਉਤਪਾਦਾਂ ਨੂੰ ਪਹੁੰਚਾਉਣ ਵਿੱਚ ਕਿਸਾਨ ਨੂੰ ਕਿਰਾਇਆ ਦੇਣ ਵਿੱਚ ਬਹੁਤ ਦਿੱਕਤ ਆਉਂਦੀ ਹੈ ਅਤੇ ਜਦੋਂ ਕਦੇ ਸਬਜ਼ੀਆਂ ਸਬਜ਼ੀ ਜਾਂ ਹੋਰ ਉਤਪਾਦ ਦੇ ਰੇਟ ਘੱਟ ਜਾਂਦੇ ਹਨ ਤਦ ਵੀ ਕਿਸਾਨ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਕਿਹੜੀ ਖੇਤੀਬਾੜੀ ਉਤਪਾਦਾਂ ਵਿੱਚ ਅਤੇ ਜਦੋਂ ਕਿਤੇ ਬਜ਼ਾਰ ਵਿੱਚ ਖਾਦ ਲੈਣ ਜਾਂਦੇ ਹਾਂ ਤਾਂ ਦੁਕਾਨਦਾਰ ਕਹਿੰਦਾ ਹੈ ਕਿ ਤੁਹਾਨੂੰ ਇਕੱਲੀ ਖਾਦ ਜਾਂ ਯੂਰੀਆ ਨਹੀਂ ਮਿਲੇਗੀ ਤੁਹਾਨੂੰ ਨਾਲ ਕੋਈ ਛੋਟੀ ਮੋਟੀ ਸਬਜ਼ੀ ਦੀ ਖਾਦ ਵੀ ਲੈਣੀ ਪੜੇਗੀ ਲੈ ਜਾਣੀ ਪੜੇ ਪਏਗੀ ਤਾਂ ਤੁਹਾਨੂੰ ਇਹ ਖਾਦ ਜਾਂ ਜਾਂ ਡਾਇਆ ਵਗੈਰਾ ਮਿਲੇਗੀ ਅਤੇ ਕਈ ਸਾਰੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਖੇਤੀਬਾੜੀ ਕਰਨੀ ਕਿਤੇ ਸੌਖੀ ਨਹੀਂ ਖੇਤੀਬਾੜੀ ਉਤਪਾਦਕ ਜੋ ਸਥਾਨਕ ਬਜ਼ਾਰ ਵਿੱਚ ਹੈ ਉੱਥੇ ਖੇਤੀਬਾੜੀ ਨਾਲੋਂ ਤਾਂ ਜ਼ਿਆਦਾ ਸਾ ਕਿਸਾਨ ਨਾਲ਼ੋਂ ਜ਼ਿਆਦਾ ਤਾਂ ਰੇਹੜੀ ਵਾਲ਼ੇ ਕਮਾ ਲੈਂਦੇ ਹਨ ਜਿਹੜੇ ਟਮਾਟਰ ਸਾਨੂੰ ਬਜ਼ਾਰ ਵਿੱਚ ਵੀਹ ਰੁਪਏ ਕਿੱਲੋ ਮਿਲਦੇ ਹਨ ਉਹ ਸਾਨੂੰ ਦੋ ਰੁਪਏ ਕਿੱਲੋ ਹੀ ਪੈ ਰਹੇ ਹਨ ਅਤੇ ਸਾਨੂੰ ਖੇਤੀਬਾੜੀ ਉਤਪਾਦਕਾਂ ਨੂੰ ਸਥਾਨਕ ਬਜ਼ਾਰਾਂ ਵਿੱਚ ਪਹੁੰਚਾਉਣ ਲਈ ਪ ਬੜੀਆਂ ਸਾਰੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ